ਹਾਂਜੀ ਉਹ ਮੈਂ ਕਿਹਾ ਸੀ ਆਪਾਂ ਉਹਦੀ ਕਰਵਾਉਣੀ ਐਡਮਿਸ਼ਨ ਪੋ ਪੋਤਰੇ ਦੀ ਅਤੇ ਸਕੂਲ ਮੈਂ ਕਿਹੜਾ ਏ ਕਿਹੜੇ 'ਚ ਕਰਵਾਈਏ ਮੈਨੂੰ ਤਾਂ ਪੰਜ ਛੇ ਸਕੂਲ ਹਾਂ ਹੈਗੇ ਸਰ ਜੀ

ਹੋਲੀ ਹਾਰਟ ਹੋਲੀ ਹਾਰਟ ਵੀ ਵੈਸੇ ਤਾਂ ਵਧੀਆ ਹੈਗਾ ਹੋਲੀ ਹਾਰਟ ਜਿਹੜਾ ਸਕੂਲ ਹੈ ਉੱਥੇ ਬੱਚੇ ਦੀ ਬੜੀ ਕੇਅਰ ਕਰਦੇ ਹੈ

ਆਟੋ ਕਿਉਂ ਬਸ 'ਤੇ ਭੇਜਾਂਗੇ ਆਟੋ ਕਿਉਂ ਬੱਸ ਵਗੈਰਾ ਵੀ ਬੱਸਾਂ ਵੀ ਜਾਂਦੀਆਂ ਨੇ ਅਤੇ ਤੁਸੀਂ ਫ੍ਰੀ ਰਹਿ ਗਏ ਜੇ ਰਟੈਰ ਹੋ ਗਏ ਜੇ ਤੂੰ ਕਾਪ 'ਤੇ ਕਾਰ ਤੇ ਛੱਡ ਕੇ ਆਇਓ ਜੇ ਹੁਣ ਮੈਂ ਐਕਟੀਵਾ 'ਤੇ ਲੈ ਆਇਆ ਕਰਾਂਗੀ ਮੈਂ ਐਕਟੀਵਾ 'ਤੇ ਉਹ